ਭਾਰਤ ਵਿੱਚ ਇਸ ਸਮੇਂ ਭੋਜਨ ਸਹੀ ਨਹੀਂ ਹੈ ਕਿਉਂਕਿ ਲੋਕ ਬਾਹਰ ਦੇ ਖਾਣੇ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਅਤੇ ਕੁਛ ਲੋਕ ਹੈ ਜੋ ਆਪਣੇ ਘਰਾਂ ਦੇ ਵਿੱਚ ਅੱਜ ਵੀ ਪੁਰਾਣੇ ਸਮੇਂ ਦੇ ਪਕਵਾਨ ਬਣਾਉਂਦੇ ਹਨ ਜਿਵੇਂ ਕਿ ਜਲੇਬੀ ਪਕੌੜੇ ਸ਼ਾਹੀ ਪਨੀਰ ਕੜਾਹੀ ਪਨੀਰ ਸਾਗ ਮੱਕੀ ਦੀ ਰੋਟੀ